ਰੂਪਨਗਰ ਜ਼ਿਲ੍ਹੇ ਵਿੱਚ ਕੁਦਰਤੀ ਸਰੋਤ ਟਿਊਬਵੈੱਲ ਸਬਮਰਸੀਬਲ ਹੈਂਡ ਪੰਪ ਆਦਿ ਹਨ ਇਥੇ ਪਾਣੀ ਦੀ ਵੀ ਵਿਵਸਥਾ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਬਹੁਤ ਬਹੁਤ ਦਿਨ ਲੋਕਾਂ ਨੂੰ ਬਿਨਾਂ ਪਾਣੀ ਤੋਂ ਗੁਜ਼ਾਰਨੇ ਪੈਂਦੇ ਹਨ ਅਤੇ ਜਿਹੜਾ ਪਾਣੀ ਆਉਂਦਾ ਹੈ ਉਹ ਵੀ ਬਹੁਤ ਗੰਦਾ ਹੁੰਦਾ ਹੈ ਜੇਕਰ ਅਸੀਂ ਵਾਤਾਵਰਨ ਸਬੰ ਸੰਬੰਧੀ ਚੁਣੌਤੀਆਂ ਦੀ ਗੱਲ ਕਰੀਏ ਤਾਂ ਇੱਥੇ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਹੈ ਪ੍ਰਦੂਸ਼ਣ ਬਹੁਤ ਜ਼ਿਆਦਾ ਹੋਣ ਕਰਕੇ ਲੋਕਾਂ ਨੂੰ ਆਪਣੀ ਸਿਹਤ ਦਾ ਬਹੁਤ ਜ਼ਿਆਦਾ ਨੁਕਸਾਨ ਸਹਿਣ ਕਰਨਾ ਪੈਂਦਾ ਹੈ ਨਗਰਪਾਲਿਕਾ ਖੇਤਰ ਦੀ ਸਫਾਈ ਤਾਂ ਕਰਦੀ ਹੈ ਪਰ ਲੋਕਾਂ ਦਾ ਇਸਦੇ ਵਿੱਚ ਜਾਗਰੂਕਤਾ ਵਿੱਚ ਘੱਟ ਯੋਗਦਾਨ ਰਹਿੰਦਾ ਹੈ